ਸਾਡੇ ਇਲਾਕੇ ਬਹੁਤ ਸਾਰੇ ਮੰਦਰ ਅਤੇ ਗੁਰਦੁਆਰੇ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਹੈ ਮਾਤਾ ਬਾਗਬਾਨੀ ਦਾ ਮੰਦਰ ਇਹ ਮੰਦਰ ਬਹੁਤ ਹੀ ਮਾਤਾ ਰਾਣੀ ਦਾ ਮੰਦਰ ਹੈ ਅਤੇ ਬਹੁਤ ਹੀ ਜ਼ਿਆਦਾ ਪ੍ਰਸਿੱਧ ਮੰਦਰ ਹੈ ਇਸ ਮੰਦਰ ਵਿੱਚ ਮਾਤਾ ਰਾਣੀ ਦੀ ਮੂਰਤ ਅਤੇ ਬਾਗ਼ ਬਣਿਆ ਹੋਇਆ ਹੈ ਜਿਸ ਵਿੱਚ ਬਹੁਤ ਹੀ ਧਾਰਮਿਕ ਜਗ੍ਹਾ ਹੈ ਇੱਥੇ ਲੋਕ ਬਹੁਤ ਸਾਰੇ ਸ਼ਰਧਾਲੂ ਅਉਂਦੇ ਹਨ ਅਤੇ ਆਪਣੀ ਚੜ੍ਹਤੇਂ ਚੜ੍ਹਾ ਕੇ ਜਾਂਦੇ ਹਨ ਇਹ ਜਗ੍ਹਾ ਐਸੀ ਹੈ ਕਿ ਲੋਕ ਬਹੁਤ ਖੁਸ਼ ਹੋ ਕੇ ਆਉਂਦੇ ਹਨ ਇਹ ਜ਼ਿਆਦਾਤਰ ਲੋਕ ਅਕਤੂਬਰ ਨਵੰਬਰ ਅਤੇ ਅਪ੍ਰੈਲ ਮਈ ਵਿੱਚ ਆਉਂਦੇ ਹਨ ਕਿਉਂਕਿ ਇਹਨਾਂ ਵਿੱਚ ਨਰਾਤਿਆਂ ਦਾ ਮੇਲਾ ਲੱਗਦਾ ਹੈ ਨਰਾਤਿਆਂ ਵਿੱਚ ਇੱਥੇ ਬਹੁਤ ਸਾਰੇ ਸ਼ਰਧਾਲੂ ਆਉਂਦੇ ਹਨ ਅਤੇ ਇੱਥੇ ਬਹੁਤ ਮੇਲੇ ਵਗੈਰਾ ਲੱਗਦੇ ਹਨ ਮੇਲਿਆਂ ਵਿੱਚ ਲੋਕ ਆਪਣਾ ਕਲਚਰ ਅਤੇ ਆਪਣਾ ਆਪ ਰਿਪ੍ਰੇਜ਼ੇਂਟ ਕਰਦੇ ਹਨ ਅਤੇ ਲੋਕਾਂ ਨੂੰ ਮਾਤਾ ਜੀ ਦੇ ਕ ਪਰਉਪਕਾਰ ਬਾਰੇ ਦੱਸਦੇ ਹਨ ਇੱਥੇ ਲੋਕ ਬਹੁਤ ਜ਼ਿਆਦਾ ਚੜ੍ਹਤਾਂ ਚੜ੍ਹਾਉਂਦੇ ਹਨ ਮੇਲੇ ਵਿੱਚ ਅਲੱਗ ਅਲੱਗ ਤਰ੍ਹਾਂ ਕਿਸਮਾਂ ਦੇ ਝੂਟੇ ਲੱਗੇ ਹੁੰਦੇ ਹਨ ਅਤੇ ਅ ਇੱਥੇ ਮਾਤਾ ਰਾਣੀ ਦੀ ਕਿਰਪਾ ਨਾਲ ਬਹੁਤ ਸੰਗਤ ਆਉਂਦੀ ਹੈ ਇੱਥੇ ਅਟੁੱਟ ਲੰਗਰ ਵਰਤਿਆ ਜਾਂਦਾ ਹੈ ਲੰਗਰ ਵਿੱਚ ਬਹੁਤ ਸਾਰੇ ਲੋਕ ਅਲੱਗ ਅਲੱਗ ਸੇਵਾ ਕਰਦੇ ਹਨ ਅਲੱਗ ਮੌਸਮ ਵਿੱਚ ਅਲੱਗ ਮੇਲੇ ਲੱਗਦੇ ਹਨ ਜਿਵੇਂ ਕਿ ਨਰਾਤਿਆਂ ਵਿੱਚ ਨੌਂ ਦਿਨ ਵਾਸਤੇ ਮੇਲਾ ਲੱਗਦਾ ਹੈ ਅਤੇ ਓ ਨੌਂਆਂ ਦਿਨਾਂ ਲਈ ਇੰਨੀ ਚਹਿਕ ਪਹਿਕ ਰਹਿੰਦੀ ਹੈ ਕਿ ਤੁਸੀਂ ਪੁੱਛੋਂ ਹੀ ਮੱਤ ਅਤੇ ਮਈ ਸੱਤ ਸ ਅਤੇ ਅਪ੍ਰੈਲ ਵਾਲੇ ਮਹੀਨਿਆਂ ਵਿੱਚ ਇੱਥੇ ਵੀ ਬਹੁਤ ਮੇਲਾ ਲੱਗਦਾ ਹੈ ਸੱਤ ਦਿਨ ਉਹ ਮੇਲਾ ਚੱਲਦਾ ਹੈ ਅਤੇ ਸਾਰੇ ਲੋਕ ਖੂਬ ਖੁਸ਼ੀ ਨਾ ਉਹ ਮੇਲੇ ਵਿੱਚ ਆਉਂਦੇ ਹਨ ਅਤੇ ਮਾਤਾ ਰਾਣੀ ਦੀ ਕਿਰਪਾ ਨਾਲ ਹਰ ਇੱਕ ਮੇਲੇ ਵਿੱਚ ਵਜਾਉਂਦੇ ਹਨ ਮੇਲੇ ਵਿੱਚ ਲੋਕ ਬਹੁਤ ਮਜ਼ੇ ਕਰਦੇ ਹਨ ਅਤੇ ਸਾਰੇ ਆਪਣੀ ਆਪਣੀ ਮਾਤਾ ਨੂੰ ਮੰਨ ਕੇ ਉੱਥੇ ਮੱਥਾ ਟੇਕਦੇ ਹਨ ਅਤੇ ਆਪਣਾ ਆਪਣੇ ਮਾਤਾ ਰਾਣੀ ਨਾਲ ਆਪਣੇ ਦੁੱਖ ਸਾਂਝੇ ਕਰਦੇ ਹਨ ਧੰਨਵਾਦ